ਜਦੋਂ ਮੈਂ ਸਕੂਲ ਵਿੱਚ ਸੀ ਤਾਂ ਉਦੋਂ ਮੈਂ ਬਹੁਤ ਡਰੋਇੰਗ ਕਰਦੀ ਸਾਂ ਪਰ ਹੁਣ ਮੈਂ ਕਾਲਜ ਵਿੱਚ ਆ ਗਈ ਹਾਂ ਅੱਜ ਕੱਲ੍ਹ ਮੇਰੇ ਕਾਲਜ ਵਿੱਚ ਪੇਪਰ ਚੱਲ ਰਹੇ ਹਨ ਜਿਸ ਕਾਰਨ ਮੈਨੂੰ ਡਰੋਇੰਗ ਕਰਨ ਦਾ ਸਮਾਂ ਨਹੀਂ ਮਿਲਦਾ ਹੈ ਮੈਨੂੰ ਪੇਪਰਾਂ ਦੀ ਤਿਆਰੀ ਕਰਨੀ ਹੁੰਦੀ ਹੈ ਜੋ ਕਿ ਵੱਡਾ ਕਾਰਨ ਹੈ ਕਿ ਮੈਂ ਡਰੋਇੰਗ ਨਹੀਂ ਕਰ ਪਾ ਰਹੀ ਹਾਂ ਕਿਉਂਕਿ ਮੈਨੂੰ ਘਰ ਦਾ ਕੰਮ ਵੀ ਹੁੰਦਾ ਹੈ ਇਸ ਕਾਰਨ ਮੈਨੂੰ ਡਰੋਇੰਗ ਕਰਨ ਦਾ ਸਮਾਂ ਨਹੀਂ ਮਿਲ ਰਿਹਾ ਹੈ ਡਰੋਇੰਗ ਕਰਨੀ ਮੈਨੂੰ ਬਹੁਤ ਚੰਗੀ ਲੱਗਦੀ ਹੈ ਪਰ ਕਈ ਕਾਰਨਾਂ ਕਾਰਨ ਮੈਂ ਡਰੋਇੰਗ ਨਹੀਂ ਕਰ ਪਾਉਂਦੀ ਹਾਂ ਜੋ ਕਿ ਮੇਰੇ ਲਈ ਬਹੁਤ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਰਹੀ ਹੈ ਮੈਂ ਜਦੋਂ ਸਕੂਲ ਵਿੱਚ ਸੀ ਤਾਂ ਉਦੋਂ ਮੇਰੀ ਇੱਕ ਡਰੋਇੰਗ ਦੀ ਟੀਚਰ ਸੀ ਜਿਸ ਤੋਂ ਹੀ ਮੈਨੂੰ ਡਰੋਇੰਗ ਕਰਨ ਦੀ ਪ੍ਰੇਰਨਾ ਮਿਲਦੀ ਹੈ ਉਹ ਬਹੁਤ ਚੰਗੀ ਅਤੇ ਸੋਹਣੀ ਡਰੋਇੰਗ ਕਰਦੇ ਸਨ ਉਨ੍ਹਾਂ ਤੋਂ ਹੀ ਮੇਨੇ ਡਰੋਇੰਗ ਸਿੱਖੀ ਹੈ ਉਹ ਮੈਨੂੰ ਬਹੁਤ ਚੰਗੀ ਤਰ੍ਹਾਂ ਸਿਖਾਉਂਦੇ ਸੀ ਮੈਂ ਜਦ ਵੀ ਮੈਨੂੰ ਟਾਈਮ ਮਿਲਦਾ ਹੈ ਤਾਂ ਮੈਂ ਥੋੜ੍ਹਾ ਸਮਾਂ ਕੱਢ ਕੇ ਡਰੋਇੰਗ ਜ਼ਰੂਰ ਕਰਦੀ ਕਿਉਂਕਿ ਡਰੋਇੰਗ ਮੇਰੇ ਮਨ ਨੂੰ ਸ਼ਾਂਤ ਕਰਦੀ ਹੈ ਅਤੇ ਮੈਨੂੰ ਚੰਗਾ ਮਹਿਸੂਸ ਕਰਵਾਉਂਦੀ ਹੈ